ਬੈਂਕ ਇੱਕ ਐਸਾ ਆਦਾਰਾ ਹੈ ਜਿਹਦੇ 'ਚ ਲੋਕ ਆਪਣੇ ਪੈਸੇ ਜਮ੍ਹਾਂ ਕਰਵਾਉਂਦੇ ਹਨ ਅਤੇ ਜ਼ਰੂਰਤ 'ਤੇ ਕਰਜ਼ਾ ਵੀ ਲੈ ਸਕਦੇ ਹਨ ਅੱਜ ਕੱਲ੍ਹ ਬਹੁਤ ਜ਼ਰੂਰੀ ਹੈ ਮਕਾਨ ਬਣਾਉਣ ਲਈ ਕਾਰਾਂ ਲੈਣ ਲਈ ਟਰੈਕਟਰ ਲੈਣ ਲਈ ਔਰ ਐਜੂਕੇਸ਼ਨ ਲੋਨ ਬੈਂਕਾਂ ਤੋਂ ਮਿਲਦਾ ਹੈ ਸਰਕਾਰ ਨੇ ਹਰ ਤਰ੍ਹਾਂ ਦੇ ਲੋਨ ਉਪਲੱਬਧ ਕਰਵਾਉਣ ਵਾਸਤੇ ਬੈਂਕਾਂ ਨੂੰ ਹਦਾਇਤਾਂ ਦਿੱਤੀਆਂ ਹਨ ਗਰੀਬਾਂ ਨੂੰ ਘੱਟ ਵਿਆਜ 'ਤੇ ਕਿਸਾਨਾਂ ਨੂੰ ਘੱਟ ਵਿਆਜ 'ਤੇ ਵੀ ਕਰਜ਼ੇ ਦਿੱਤੇ ਜਾਂਦੇ ਹਨ ਜਿਹੜੇ ਬੈਂਕਾਂ ਤੋਂ ਕਰਜ਼ੇ ਲਏ ਜਾਂਦੇ ਹਨ ਉਹ ਸਾਰੇ ਰਜਿਸਟਰਡ ਅਤੇ ਮਨਜ਼ੂਰ ਸ਼ੁੁਦਾ ਹੁੰਦੇ ਹਨ ਇਹਦੇ ਤੋਂ ਇਲਾਵਾ ਵੀ ਕਈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸ਼ਾਹੂਕਾਰਾ ਜਿਹੜੇ ਪੈਸੇ ਉਧਾਰ ਦਿੰਦੇ ਨੇ ਅਤੇ ਵਿਆਜ ਲੈਂਦੇ ਨੇ ਸੁਨਿਆਰੇ ਵੀ ਇਹ ਕੰਮ ਕਰਦੇ ਹਨ ਅਤੇ ਦੂਜੇ ਵੀ ਸ਼ਾਹੂਕਾਰ ਪਿੰਡਾਂ 'ਚ ਇਹ ਕੰਮ ਕਰਦੇ ਹਨ ਜਿਹੜਾ ਪੈਸਿਆਂ ਦਾ ਲੈਣ ਦੇਣ ਉਹ ਆਪਣੇ ਉਧਾਰ ਖਾਤੇ ਦੇ ਵਿੱਚ ਕਰਕੇ ਲੋਕਾਂ ਕੋਲੋਂ ਉਗਰਾਹੀ ਕਰਦੇ ਹਨ